ਹਾਂਜੀ ਹਾਂਜੀ ਹਾਂਜੀ ਹਾਂਜੀ ਮੈਨੂੰ ਨੌਲੇਜ ਹੈਗੀ ਹਾਂਜੀ ਮੈਂ ਜ਼ਰੂਰ ਹੈਲਪ ਕਰਾਂਗੀ ਇੱਥੇ ਬਹੁਤ ਸਾਰੀਆਂ ਜਿਵੇਂ ਕਿ ਓਵਨ ਫਰੈਸ਼ ਹੋਗੀ ਗੌਤਮ ਦੇ ਡੋਨਟ ਕਲੱਬ ਓਮ ਬੇਕਰਸ ਮਹਾਂਵੀਰ ਬੇਕਰ ਬਹੁਤ ਸਾਰੀਆਂ ਹੈ ਹਾਂਜੀ ਡਰਾਇਗਰੇਟਸ ਜੋ ਬਹੁਤ ਫੇਮਸ ਹੈ ਇਹ ਸਭ ਤੋਂ ਜ਼ਿਆਦਾ ਇਹ ਹੀ ਮਤਲਬ ਕਿ ਸਭ ਸਭ ਨੂੰ ਪਸੰਦ ਹੈ ਹਾਂਜੀ ਜ਼ਰੂਰ ਮੈਂ ਅਗਰ ਤੁਸੀਂ ਜਾਂਦੇ ਹੋ ਮੈਂ ਤੁਹਾਡੇ ਨਾਲ ਵੀ ਚੱਲਾਂਗੀ ਕੋਈ ਚੱਕਰ ਨਹੀਂ ਮੈਂ ਤੁਹਾਡੀ ਹੈਲਪ ਕਰ ਦੂੰਗੀ ਓਕੇ